ਪੰਜਾਬ ਵਿੱਚ ਬੈਂਕਾਂ ਜਾਂ ਵਿਧੀ ਸੰਸਥਾਵਾਂ ਸੰਚਾਲਨ ਨੂੰ ਨਿਅੰਤਰਿਤ ਕਰਨ ਵਾਲੇ ਪ੍ਰਮੁੱਖ ਬੈਂਕਿੰਗ ਜਾਂ ਬੀਮਾ ਨਿਯਮ ਜਾਂ ਕਾਨੂੰਨ ਜੋ ਵੀ ਹਨ ਉਹ ਇਸ ਪ੍ਰਕਾਰ ਹਨ ਜਿਵੇਂ ਕਿ ਭਾਰਤੀ ਰਿਜਰਵ ਬੈਂਕ ਇਹ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਹੀ ਬੈਂਕਾਂ ਨੂੰ ਨਿਅੰਤਰਿਤ ਕਰਦਾ ਹੈ ਕਿਸ ਬੈਂਕ ਦੇ ਵਿੱਚ ਕਿਸ ਤਰ੍ਹਾਂ ਦੇ ਖਾਤੇ ਹੋਣਗੇ ਇੱਕ ਬੈਂਕ ਦੇ ਵਿੱਚ ਅਗਰ ਜੇ ਸੇਵਿੰਗ ਖਾਤਾ ਹੈ ਜਿਸਦੇ ਵਿੱਚ ਇੱਕ ਗ੍ਰਾਹਕ ਕਿਹਨੇ ਪੈਸੇ ਰੱਖ ਸਕਦਾ ਹੈ ਉਹਨੂੰ ਕਿਸ ਤਰ੍ਹਾਂ ਦੀ ਵਿਆਜ ਕਿਸ ਵਿਆਜ ਦਰ ਤੇ ਉਹਨੂੰ ਉਹਦੇ ਪੈਸੇ ਮਿਲਣਗੇ ਇਹ ਸਾਰਾ ਕੁਝ ਰਿਜ਼ਰਵ ਬੈਂਕ ਹੀ ਨਿਯੰਤਰਿਤ ਕਰਦਾ ਹੈ ਤੇ ਜਿੱਥੋਂ ਤੱਕ ਇਹ ਗੱਲ ਕੀਤੀ ਜਾਵੇ ਗ੍ਰਾਹਕ ਦੇ ਨਾਲ ਕਿੰਨੇ ਤਰ੍ਹਾਂ ਦਾ ਲੈਣ ਦੇਣ ਕਿਸ ਹਿਸਾਬ ਨਾਲ ਕੀਤਾ ਜਾਏਗਾ ਕਿਸ ਕਿਸ ਤਰ੍ਹਾਂ ਦੇ ਖਾਤੇ ਬੈਂਕ ਦੇ ਵਿੱਚ ਖੋਲੇ ਜਾ ਸਕੇ ਲੋਨ ਕਿਸ ਤਰ੍ਹਾਂ ਦੇ ਦਿੱਤੇ ਜਾ ਸਕਦੇ ਹਨ ਇਹ ਸਾਰਾ ਕੁਝ ਬੈਂਕ ਇਹ ਦੱਸਣ ਭਾਰਤੀ ਰਿਜ਼ਰਵ ਬੈਂਕ ਹੀ ਇਸਨੂੰ ਸਾਰਾ ਨਿਯੰਤਰਿਤ ਕਰਦਾ ਹੈ ਜਿੱਥੋਂ ਤੱਕ ਇਹ ਗੱਲ ਹੈ ਬੀਮਾ ਦੀ ਤੇ ਕਿਸ ਤਰ੍ਹਾਂ ਦੇ ਬੀਮੇ ਕੀਤੇ ਜਾਣਗੇ ਜੀਵਨ ਸੁਰਕਸ਼ਾ ਵਾਸਤੇ ਤੇ ਉਹਦੇ ਵਿੱਚ ਪਰਿਵਾਰਕ ਪਰਿਵਾਰ ਦੇ ਕਿਹੜੇ ਕਿਹੜੇ ਜਿਹੜੇ ਹੈ ਮੈਂਬਰ ਐਡ ਕੀਤੇ ਜਾਣਗੇ ਕਿੰਨੀ ਕਿਸ਼ਤ ਮਹੀਨੇ ਦੀ ਕਿੰਨੀ ਦਰ ਤੇ ਦਿੱਤੀ ਜਾਵੇਗੀ ਇੱਕ ਇਨਸਾਨ ਨੂੰ ਇੱਕ ਗਾਹਕ ਨੂੰ ਕਿੰਨੀ ਕਿਸ਼ਤ ਪਰ ਮਹੀਨੇ ਦੇ ਹਿਸਾਬ ਨਾਲ ਦੇਣੀ ਪਏਗੀ ਤੇ ਉਸਨੂੰ ਉਸਦੇ ਕੀ ਕੀ ਲਾਭ ਮਿਲਣਗੇ ਇਹ ਸਾਰਾ ਕੁਝ ਇਹ ਸਾਰੇ ਨਿਯਮ ਬਣਾਏ ਗਏ ਧੰਨਵਾਦ